ਹਾਂਜੀ ਮੈਂ ਜਿਵੇਂ ਕਿ ਥੋੜ੍ਹੀ ਬਹੁਤ ਸਿਲਾਈ ਹੀ ਜਾਣਦੀ ਹਾਂ ਥੋੜ੍ਹੀ ਬਹੁਤ ਸਿੰਪਲ ਸੂਟ ਸਿਖ ਸਿਓਣਾ ਹੀ ਜਾਣਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਇੱਕ ਨਵੇਂ ਫੈਸ਼ਨ ਜਿਹੜੇ ਹਨ ਵੱਖ ਵੱਖ ਟਰੈਂਡ ਦੇ ਕੱਪੜੇ ਚੱਲਦੇ ਆ ਵੈਸਟਨ ਕੱਪੜੇ ਚਲਦੇ ਆ ਲਹਿੰਗੇ ਹੋਰ ਸ਼ੋਟ ਕੁੜਤੀਜ਼ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਪਾਉਂਦੀਆਂ ਵੈਸਟਰਨ ਕੱਪੜੇ ਪਾਉਣ ਦੀਆਂ ਮੈਂ ਉਹਨਾਂ ਦੀ ਤਰ੍ਹਾਂ ਹੀ ਉ ਵੈਸਟਨ ਕੱਪੜੇ ਸਿਓਣਾ ਜਿਹੜੇ ਆ ਉਹ ਚਾਹਵਾਂਗੀ ਅਤੇ ਉਹ ਸਿੱਖਣਾ ਚਾਹੁੰਦੀ ਹਾਂ ਜਾਂ ਅਲਗ ਅਲਗ ਵੱਖ ਵੱਖ ਫੈਸ਼ਨ ਤਰ੍ਹਾਂ ਦੇ ਅੱਜ ਕੱਲ੍ਹ ਦੇ ਕੱਪੜੇ ਚਲੇ ਦੇ ਆ ਮੈਂ ਹਰ ਇੱਕ ਕੱਪੜਾ ਜਿਹੜਾ ਹੈ ਉਹ ਸਿੱਖਣਾ ਚਾਹਵਾਂਗੀ ਜਿਵੇਂ ਕਿ ਅੱਜ ਕੱਲ੍ਹ ਹੱਥੀਂ ਜਿਹੜੇ ਆ ਕਢਾਈ ਦੀਆਂ ਕੁੜਤੀਆਂ ਚਲਦੀਆਂ ਹੈ ਮੈਂ ਉਹ ਕੁੜਤੀਆਂ ਜਿਹੜੀਆਂ ਸਿੱਖਣਾ ਚਾਹਵਾਂਗੀ ਅਲਟਰਨੇਟ ਮਸ਼ੀਨ ਦੇ ਰਾਹੀਂ ਜਿਹੜੇ ਆ ਅੱਜ ਕੱਲ੍ਹ ਜਿਹੜੇ ਅਲਟਰਨੇਟ ਮਸ਼ੀਨ ਚਲਦੀ ਹੈ ਮੈਂ ਉਹ ਸਿੱਖਣਾ ਚਾਹਵਾਂਗੀ ਉਹਦੇ ਰਾਹੀਂ ਹੀ ਮੈਂ ਜਿਹੜੀਆਂ ਅੱਜ ਵੱਖ ਵੱਖ ਟਰੈਂਡ ਦੇ ਜਿਹੜੇ ਕੱਪੜੇ ਪਾਉਂਦੇ ਹੈ ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਵੱਖ ਵੱਖ ਟਰੈਂਡ ਦੇ ਹਰ ਤਰ੍ਹਾਂ ਦੇ ਫੈਸ਼ਨ ਦਾ ਕੱਪੜਾ ਅਵੇਲੇਬਲ ਹੈ ਅਤੇ ਮੈਂ ਉਸ ਤਰ੍ਹਾਂ ਦੇ ਕੱਪੜੇ ਜਿਹੜੇ ਹੈ ਸਿੱਖਣ ਵਿੱਚ ਰੁਚੀ ਰੱਖਦੀ ਹਾਂ ਤਾਂ ਜੋ ਮੈਂ ਇੱਕ ਵਧੀਆ ਜਿਹੜੀ ਆ ਮਸ਼ੀਨ ਜਿਹੜੀ ਆ ਵਧੀਆ ਤਰੀਕੇ ਨਾਲ ਜਿਹੜੇ ਆ ਸਿਲਾਈ ਕਢਾਈ ਵਿੱਚ ਮਾਹਿਰ ਹੋ ਸਕਾਂ ਅਤੇ ਬਹੁਤ ਹੀ ਜ਼ਿਆਦਾ ਮਾਹਿਰ ਹੋ ਸਕਾਂ ਕਿ ਮੈਂ ਅੱਜ ਕੱਲ੍ਹ ਦੇ ਵੱਖ ਵੱਖ ਟਰੈਂਡ ਦੇ ਅਤੇ ਹਰ ਤਰ੍ਹਾਂ ਦੇ ਕੱਪੜੇ ਜਿਹੜੇ ਆ ਉਹ ਸਿਓਂ ਸਕਾਂ ਔਰ ਮੈਂ ਕੱਪੜੇ ਸਿਓਣ ਦੇ ਨਾਲ ਨਾਲ ਹੀ ਜਿਹੜੀ ਹੈ ਕਢਾਈ ਜਿਹੜੀ ਕਸ਼ਮੀਰੀ ਕੁੜਤੇ ਜਿਹੜੇ ਆ ਉਹਨਾਂ ਦੀ ਕਢਾਈ ਜਿਹੜੀ ਆ ਅੱਜ ਕੱਲ੍ਹ ਦੇ ਟਰੈਂਡ ਹੈ ਮੈਂ ਉਹ ਵੀ ਸਿੱਖਣਾ ਚਾਹਵਾਂਗੀ ਹੋਰ ਵੱਖ ਵੱਖ ਟਰੈਂਡ ਜਿੱਦਾਂ ਕਿ ਵੈਸਟਨ ਕੱਪੜੇ ਲਹਿੰਗੇ ਸਾੜੀਜ ਬੁਲਾਉਚ ਉਹਨਾਂ ਦੀ ਸਟੀਚਿੰਗ ਇਹ ਸਾਰੀ ਕੱਪੜੇ ਜਿਹੜੇ ਹੈ ਉਹ ਉਹਨਾਂ ਨੂੰ ਸਟਿਚਿੰਗ ਕਰਨਾ ਜਿਹੜਾ ਆ ਉਹ ਸਿੱਖਣਾ ਚਾਹੁੰਦੀ ਹਾਂ